ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ੍ਹ ਔਨਲਾਈਨ ਦਾ ਰਿਵਾਜ ਜਿਹੜਾ ਟਰੈਂਡ ਆ ਹੈ ਨਾ ਉਹ ਚੱਲੀ ਜਾਂਦਾ ਹਰ ਕੋਈ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਚਾਹੁੰਦਾ ਵੀ ਘਰੇ ਬੈਠੇ ਹੀ ਸਭ ਕੁਛ ਮਿਲ ਜਾਏ ਤਾਂ ਜ਼ਿਆਦਾਤਰ ਔਨਲਾਈਨ ਹੀ ਆਪਾਂ ਚੀਜ਼ਾਂ ਮੰਗਾਉਂਦੇ ਹਾਂ ਤਾਂ ਮੈਂ ਤੁਹਾਡੇ ਨਾਲ ਆਪਦਾ ਇੱਕ ਐਕਸਪੀਰੀਅਸ ਸਾਂਝਾ ਕਰਨਾ ਕਿ ਮੈਂ ਨਾ ਇੱਕ ਬੈਡ ਸ਼ੀਟ ਮੰਗਾਈ ਸੀ ਹੈ ਨਾ ਔਨਲਾਈਨ ਅਤੇ ਉਹ ਜਦੋਂ ਬੈਡ ਸ਼ੀਟ ਮੇਰੇ ਕੋਲ ਪਹੁੰਚੀ ਹੈ ਨਾ ਅਤੇ ਪਹਿਲੀ ਗੱਲ ਤਾਂ ਉਹ ਉਹਨਾਂ ਨੇ ਸਮਾਂ ਦਿੱਤਾ ਸੀ ਚਾਰ ਪੰਜ ਦਿਨਾਂ ਦਾ ਅਤੇ ਅੱਠ ਨੌ ਦਿਨਾਂ 'ਚ ਮੇਰੇ ਕੋਲ ਪਹੁੰਚੀ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਰਸੀਵ ਕੀਤਾ ਤਾਂ ਉਹਦੀ ਜਿਹੜੀ ਪੈਕਿੰਗ ਸੀ ਨਾ ਬੈਡ ਸ਼ੀਟ ਦੀ ਉਹ ਪੂਰੀ ਐ ਗੁੱਥੀ ਹੋਈ ਸੀ ਜਿਵੇਂ ਘੜੇ 'ਚੋਂ ਕੋਈ ਕੱਪੜਾ ਕੱਢਦੇ ਹੁੰਦੇ ਆ ਆਪਾਂ ਹੈ ਨਾ ਪੂਰੇ ਵਲ ਪਏ ਹੋਏ ਸੀ ਉਹ 'ਚ ਅਤੇ ਇੱਕ ਜਿਹੜਾ ਉਹਨਾਂ ਨੇ ਦਿਖਾਇਆ ਸੀਗਾ ਔਨਲਾਈਨ ਅਤੇ ਉਹਨਾਂ ਨੇ ਕਿਹਾ ਸੀ ਵੀ ਪਿਓਰ ਕੋਟਨ ਜਦੋਂ ਮੈਂ ਖੋਲ੍ਹ ਕੇ ਦੇਖੀ ਤਾਂ ਉਹ ਪਿਓਰ ਕੋਟਨ ਵਾਲੀ ਤਾਂ ਉਹਦੇ 'ਚ ਕੋਈ ਗੱਲ ਹੀ ਨਹੀਂ ਸੀ ਸਿੰਥੈਟਿਕ ਸੀ ਦੂਜਾ ਰੰਗ ਉਹਦਾ ਇੰਨਾ ਡਲ ਸੀਗਾ ਇੰਨਾ ਭੱਦਾ ਰੰਗ ਸੀਗਾ ਵੀ ਮਤਲਬ ਦਿਖਾਇਆ ਕੁਛ ਹੋਰ ਸੀ ਅਤੇ ਭੇਜਿਆ ਕੁਛ ਹੋਰ ਸੀ ਮੇਰਾ ਮਨ ਇੰਨਾ ਖਰਾਬ ਹੋਇਆ ਨਾ ਮੈਂ ਕਿਹਾ ਚਲੋ ਵੀ ਆਪਾਂ ਵਿਛਾਉਣੀ ਤਾਂ ਹੁਣ ਹੈਗੀ ਆ ਜਦੋਂ ਮੈਂ ਉਹਨੂੰ ਧੋਣ ਲੱਗੀ ਅਤੇ ਉਹ 'ਚੋਂ ਇੰਨਾ ਰੰਗ ਨਿਕਲਿਆ ਮਤਲਬ ਉਹਦਾ ਰੰਗ ਜਿਹੜਾ ਉਸ ਟਾਈਮ ਆਇਆ ਸੀ ਅਤੇ ਉਹ ਧੋਣ ਤੋਂ ਬਾਅਦ ਜਿਹੜਾ ਰੰਗ ਸੀ ਮਤਲਬ ਤੁਸੀਂ ਪਹਿਚਾਣ ਹੀ ਨਹੀਂ ਸਕਦੇ ਸੀ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਕਈ ਵਾਰ ਤਾਂ ਨਾ ਔਨਲਾਈਨ 'ਤੇ ਚੀਜ਼ਾਂ ਵਧੀਆ ਵੀ ਨਿਕਲੀਆਂ ਆਉਂਦੀਆਂ ਪਰ ਮੇਰੇ ਨਾਲ ਤਾਂ ਜਿਹੜਾ ਐਕਸਪੀਰੀਅਸ ਹੁੰਦਾ ਉਹ ਜ਼ਿਆਦਾਤਰ ਖਰਾਬ ਹੀ ਹੁੰਦਾ ਮਤਲਬ ਮੈਂ ਇੱਕ ਦੋ ਚੀਜ਼ਾਂ ਜਿਹੜੀਆਂ ਵੀ ਮੰਗਾਉਂਦੀ ਹਾਂ ਉਹ ਇਹੋ ਜਿਹੀਆਂ ਹੀ ਨਿਕਲਦੀਆਂ ਨੇ ਨੈਗੇਟਿਵ ਤਾਂ ਬੈਡ ਸ਼ੀਟ ਜਦੋਂ ਮੈਂ ਮੰਗਾਈ ਮੇਰਾ ਤਾਂ ਨਾ ਔਨਲਾਈਨ ਸ਼ੋਪਿੰਗ ਤੋਂ ਯਕੀਨ ਹੀ ਉੱਠ ਗਿਆ ਇੰਨੀ ਮਤਲਬ ਸੜੀ ਉਹ ਚਾਦਰ ਆਈ ਮੇਰੇ ਕੋਲ ਕਿ ਹੁਣ ਮੇਰਾ ਉਹਨੂੰ ਵਿਛਾਉਣ ਨੂੰ ਜੀ ਵੀ ਨਹੀਂ ਕਰਦਾ ਮੈਂ ਤਾਂ ਅਲਮਾਰੀ ਦੇ ਇੱਕ ਖੂੰਜੇ 'ਚ ਹੀ ਰੱਖ ਰੱਖੀ ਹੈ ਤਾਂ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਿਆ ਇਹ ਤਾਂ ਮੈਂ ਸੋਚਦੀ ਹਾਂ ਵੀ ਇਹਦੇ ਨਾਲੋਂ ਚੰਗਾ ਤਾਂ ਦੁਕਾਨ 'ਤੇ ਜਾ ਕੇ ਹੀ ਲੈ ਲਓ ਜੇ ਪੈਸੇ ਹੀ ਲਾਉਣੇ ਆ ਤਾਂ ਧੰਨਵਾਦ